ਹਾਂ ਮੈਂ ਰਵਾਇਤੀ ਤੌਰ 'ਤੇ ਪੈੱਨ ਨਾਲ ਕਾਗਜ਼ 'ਤੇ ਲਿਖਣਾ ਪਸੰਦ ਕਰਦੀ ਹਾਂ ਪਰ ਅੱਜ ਕੱਲ੍ਹ ਲੈਪਟੋਪ ਅਰ ਮੋਬਾਈਲ 'ਤੇ ਟਾਈਪ ਕਰਨਾ ਵੀ ਚ ਕ ਬਹੁਤ ਜ਼ਿਆਦਾ ਚੱਲ ਰਿਹਾ ਹੈ ਅੱਜ ਲੈਪਟਾਪ ਅਤੇ ਮੋਬਾਇਲ ਵਿੱਚ ਟਾਈਪ ਕਰਨ ਨਾਲ ਜਿਹੜਾ ਸਾਡਾ ਲਿਖਿਤ ਚੀਜਾਂ ਹੁੰਦੀਆਂ ਹਨ ਉਹ ਕਿਸੀ ਤੌਰ ਤਰੀਕੇ ਨਾਲ ਸ ਸੁਰੱਖਸ਼ਿਤ ਰਹਿੰਦੀਆਂ ਹਨ ਪੈੱਨ ਪੈੱਨ ਪੈੱਨ ਪੈਨਸਿਲ ਕਾਗਜ਼ 'ਤੇ ਲਿਖੀਆਂ ਹੋਈਆਂ ਚੀਜ਼ਾਂ ਕਈ ਹੱਦ ਤੱਕ ਗੁੰਮ ਵੀ ਜਾਂਦੀਆਂ ਹਨ ਅਤੇ ਖਰਾਬ ਵੀ ਹੋ ਜਾਂਦੀਆਂ ਹਨ ਇਸ ਲਈ ਅੱਜ ਕੱਲ੍ਹ ਲੋਕ ਲੈਪਟੋਪ ਮੋਬਾਈਲ 'ਤੇ ਲਿਖਣਾ ਟਾਈਪ ਕਰਨਾ ਜ਼ਿਆਦਾ ਪਸੰਦ ਕਰਦੇ ਹਨ